ਹਾਂਜੀ ਮੈਂ ਕਲਪਨਾ ਚਾਵਲਾ ਸੁਨੀਤਾ ਵਿਲੀਅਮ ਰਾਕੇਸ਼ ਸ਼ਰਮਾ ਜੀ ਬਾਰੇ ਗੱਲ ਕਰਨਾ ਚਾਹਾਂਗਾ ਸਗੋਂ ਮੇਰੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂ ਇਹਨਾਂ ਬਾਰੇ ਕੁਝ ਕਹਿਣਾ ਚਾਹਾਂਗਾ ਇਹ ਸਾਰੇ ਬਹੁਤ ਵਧੀਆ ਸਨ ਸਾਰੇ ਐਸਟਰੋਨੋਟ ਸਨ ਜੋ ਕਿ ਚੰਦਰਮਾ ਉੱਪਰ ਜਾਕਰ ਖੋਜ ਕਰਦੇ ਸਨ ਅਤੇ ਕਲਪਨਾ ਚਾਵਲਾ ਦੇਖੋ ਜੀ ਸਾਡੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਕਲਪਨਾ ਚਾਵਲਾ ਨੇ ਸਾਡੇ ਪੰਜਾਬ ਦਾ ਮਾਣ ਉਹ ਵਧਾਇਆ ਕਿਉਂਕਿ ਉਹ ਸਾਡੇ ਪੰਜਾਬ ਦੀ ਧੀ ਸੀ ਉਹਨਾਂ ਨੇ ਚੰਦਰਮਾ 'ਤੇ ਜਾ ਕੇ ਪੂਰੀ ਸਰਚ ਕੀਤੀ ਖੋਜ ਕੀਤੀ ਉੱਥੇ ਜਾ ਕੇ ਫਿਰ ਉਹ ਉਹਨਾਂ ਦਾ ਸਮਾਂ ਮਾੜਾ ਕਹਿ ਲਓ ਜਾਂ ਕਿੱਦਾਂ ਉਹ ਮ ਕਿ ਧਰਤੀ 'ਤੇ ਵਾਪਸ ਨਹੀਂ ਆ ਸਕੇ ਜੋ ਕਿ ਬੜੇ ਹੀ ਬਹੁਤ ਹੀ ਮਾੜੀ ਗੱਲ ਹੈ ਪਰ ਫਿਰ ਵੀ ਅਜੇ ਵੀ ਉਹਨਾਂ ਦਾ ਜ਼ਿਕਰ ਹਮੇਸ਼ਾ ਰਹੇਗਾ ਕਿਉਂਕਿ ਹਰ ਕੋਈ ਉਹਨਾਂ ਵਾਂਗ ਬਣਨਾ ਚਾਹੁੰਦਾ ਹੈ ਉਹਨਾਂ ਕੋਲੋਂ ਉਹਨਾਂ ਬਾਰੇ ਸਰਚ ਕਰ ਕਰਕੇ ਉਹਨਾਂ ਕੋਲੋਂ ਬਹੁਤ ਕੁਝ ਸਿੱਖਣਾ ਚਾਹੁੰਦੇ ਸਨ ਕਿ ਜੋ ਜੋ ਕਲਪਨਾ ਚਾਵਲਾ ਨੇ ਕੀਤਾ ਹੈ ਜੋ ਉਹਨਾਂ ਦਾ ਅਧੂਰਾ ਰਹਿ ਗਿਆ ਉਹ ਅਸੀਂ ਪੂਰਾ ਕਰ ਸਕੀਏ ਜੋ ਕਿ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਧੰਨਵਾਦ